ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂ ਹਾਂਜੀ ਮੈਂ ਅੰਮ੍ਰਿਤਸਰ ਸਾਹਿਬ ਤੋਂ ਆ ਰਿਹਾ ਜੀ ਮੇਰੇ ਫਰੈਂਡ ਰਹਿੰਦੇ ਸੀਗੇ ਜੀ ਇੱਥੇ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਆ ਰਿਹਾ ਜੀ ਮੈਂ ਅਤੇ ਮੈਂ ਇੱਥੇ ਦੋ ਦਿਨਾਂ ਦੀਆਂ ਮੈਨੂੰ ਛੁੱਟੀਆਂ ਨੇ ਜੀ ਤਾਂ ਮੈਂ ਘੁੰਮਣ ਲਈ ਆ ਰਿਹਾ ਸੀਗਾ ਅਤੇ ਤੁਸੀਂ ਮੈਨੂੰ ਇੱਥੇ ਘੁੰਮਣ ਲਈ ਜੋ ਜੋ ਵਧੀਆ ਪਲੇਸਿਸ ਨੇ ਉਹਦੇ ਬਾਰੇ ਗਾਈ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਹਾਂਜੀ ਠੀ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਅੱਛਾ ਠੀਕ ਹੈ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਮੈਂ ਬਾਏ ਬੱਸ ਆਊਂਗਾ ਜੀ ਤੁਸੀਂ ਮੈਨੂੰ ਬਸ ਸਟੈਂਡ ਤੋਂ ਪਿਕ ਕਰ ਲਿਓ ਕਿਉਂਕਿ ਮੈਨੂੰ ਇੱਥੇ ਬਸ ਸਟੈਂਡ ਤੋਂ ਗਾਹਾਂ ਕੁਛ ਪਤਾ ਨਹੀਂ ਹੈਗਾ ਜੀ ਵੀ ਮੈਂ ਕਿੱਥੇ ਜਾਣਾ ਕਿਸ ਤਰਫ ਕੋਈ ਬੱਸ ਸਟੈਂਡ ਆ ਜਾਂ ਕੋਈ ਰਹਿਣ ਲਈ ਹੋਟਲ ਵਗੈਰਾ ਕੁਛ ਮਿਲੇਗਾ ਹੈ ਨਾ ਹਾਂਜੀ ਹਾਂਜੀ ਹਾਂਜੀ ਹਾਂਜੀ ਓਕੇ ਜੀ